ਸਕੂਲ ਸਲਾਹਕਾਰ ਨੂੰ ਪੁੱਛਣਾ ਨਮਸਤੇ ਸਰ ਮੈਡਮ ਮੈਂ ਹਾਲ ਹੀ ਵਿੱਚ ਅਠਾਰ੍ਹਾਂ ਸਾਲ ਦਾ ਹੋ ਗਿਆ ਹਾਂ ਅਤੇ ਮੈਨੂੰ ਆਪਣਾ ਆਧਾਰ ਕਾਰਡ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈ

ਤੁਹਾਨੂੰ ਸਭ ਤੋਂ ਪਹਿਲੇ ਆਪਣੇ ਨਜ਼ਦੀਕੀ ਆਧਾਰ ਦਾਖਲਾ ਕੇਂਦਰ ਦੀ ਲੱਭਣਾ ਹੈ ਤੁਸੀਂ ਇਹ ਫਾਰਮ ਨਿਯਮਿਤ ਤਰੀਕੇ ਨਾਲ ਭਰ ਸਕਦੇ ਹੋ ਪਹਿਲਾ ਆਧਾਰ ਕਾਰਡ ਦੀ ਅਧਿਕਾਰਿਤ ਵੈਬਸਾਈਟ ਯੂ ਆਈ ਡੀ ਏ ਆਈ ਗਵਰਮੈਂਟ ਡੋਟ ਇਨ 'ਤੇ ਜਾਉ ਦੂਜਾ ਮਾਈ ਆਧਾਰ ਵਿਕਲਪ 'ਤੇ ਕਲਿੱਪ ਕਰੋ ਤੀਜਾ ਆਧਾਰ ਇਨਰੋਲਮੈਂਟ ਸੈਂਟਰ ਵਿਕਲਪ ਚੁਣੋ ਚੌਥਾ ਆਪਣਾ ਰਾਜ ਜ਼ਿਲ੍ਹਾ ਅਤੇ ਸ਼ਹਿਰ ਚੁਣੋ ਪੰਜਵਾਂ ਨਜ਼ਦੀਕੀ ਦਾਖਲਾ ਕੇਂਦਰਾਂ ਦੀ ਸੂਚੀ ਵੇਖੋ ਦਾਖਲਾ ਕੇਂਦਰ ਜਾਣ ਲਈ ਜ਼ਰੂਰੀ ਕਦਮ ਆਪਣੀ ਦਸਤਾਵੇਜ਼ ਤਿਆਰ ਕਰੋ ਜਨਮ ਪਰਮਾਣ ਪੱਤਰ ਪਛਾਣ ਪ੍ਰਮਾਣ ਪੱਤਰ ਪਤੇ ਦਾ ਪ੍ਰਮਾਣ ਪੱਤਰ